ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਸਿਹਤ ਸੰਭਾਲ ਪ੍ਰਣਾਲੀ ਡਾਕਟਰੀ ਸਹੂਲਤਾਂ ਅਤੇ ਹੋਰ ਵੀ ਸੇਵਾਵਾਂ ਜਿਹੜੀਆਂ ਨੇ ਉਪਲੱਬਧ ਹਨ ਬਹੁਤ ਵਧੀਆ ਹਨ ਜਦੋਂ ਕਿਸੇ ਥਾਂ 'ਤੇ ਦੁਰਘਟਨਾ ਹੁੰਦੀ ਹੈ ਜਾਂ ਕਿਸੇ ਜ਼ਖਮੀ ਨੂੰ ਲੋੜ ਹੁੰਦੀ ਹੈ ਤਾਂ ਜਿਹੜੀ ਸਿਹਤ ਸੰਭਾਲ ਦੀ ਪ੍ਰਣਾਲੀ ਹੁੰਦੀ ਹੈ ਡਾਕਟਰੀ ਸਹੂਲਤ ਹੁੰਦੀ ਹੈ ਉੱਥੇ ਬਹੁਤ ਜਲਦੀ ਪਹੁੰਚ ਜਾਂਦੀ ਹੈ ਅਤੇ ਜ਼ਖਮੀ ਨੂੰ ਜਿਹੜੀ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ ਉਹ ਬਹੁਤ ਜਲਦੀ ਪਹੁੰਚਾਈ ਜਾਂਦੀ ਹੈ ਜ਼ਿਆਦਾ ਜ਼ਖਮੀ ਵਿਅਕਤੀ ਨੂੰ ਅਸਪਿਟ ਹਸਪਤਾਲ ਪਹੁੰਚਾਉਣ ਦੇ ਲਈ ਐਬੂਲੈਂਸ ਦਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਫਿਰ ਉਹਨੂੰ ਹਸਪਤਾਲ ਲੈ ਜਾਇਆ ਜਾਂਦਾ ਹੈ ਉੱਥੇ ਜਾ ਕੇ ਜੋ ਉਸ ਦਾ ਫ੍ਰੀ ਇਲਾਜ ਵੀ ਕੀਤਾ ਜਾਂਦਾ ਹੈ ਸਥਾਨਕ ਭਾਈਚਾਰੇ ਦੀਆਂ ਜਿਹੜੀਆਂ ਲੋੜਾਂ ਵਾ ਉਹ ਵੀ ਪੂਰਾ ਕਰਦੀ ਆ ਸਿਹਤ ਸੰਭਾਲ ਪ੍ਰਣਾਲੀ ਭਾਈਚਾਰੇ ਦੀਆਂ ਜਿਹੜੇ ਗਰੀਬ ਹੁੰਦੇ ਆ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾਂਦਾ ਹੈ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਂਦਾ ਹੈ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜਿੱਥੋਂ ਤੱਕ ਹੋ ਸਕਦਾ ਉਹਨਾਂ ਦੀ ਪੂਰੀ ਪੂਰੀ ਸਹਾਇਤਾ ਕੀਤੀ ਜਾਂਦੀ ਹੈ ਇਹ ਸਾ ਸਿਹਤ ਸੰਭਾਲ ਪ੍ਰਣਾਲੀ ਡਾਕਟਰੀ ਸਹੂਲਤਾਂ ਸੇਵਾਵਾਂ ਭਾਈਚਾਰਕ ਲੋੜਾਂ ਨੂੰ ਜੋ ਵੀ ਹੈ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਸੰਭਾਲ ਅ ਤਰੀਕੇ ਦੇ ਨਾਲ ਮਤਲਬ ਪੂਰਾ ਕੀਤਾ ਜਾਂਦਾ ਹੈ ਬਹੁਤ ਵਧੀਆ ਪ੍ਰਣਾਲੀ ਹੈ ਸਾਡੇ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਥੈਂਕ